ਹੈਲੋ ਹਾਂਜੀ ਸਿਮਰਪ੍ਰੀਤ ਸਿੰਘ ਮੈਂ ਤੁਹਾਡੀ ਐਡਮਿਨਸਟ੍ਰੇਸ਼ਨ ਦੀ ਇੰਚਾਰਜ ਗੱਲ ਕਰਦੀ ਪਈ ਹਾਂ ਸਤਿ ਸ਼੍ਰੀ ਅਕਾਲ ਬੱਚੇ ਮੈਂ ਪੁੱਛਣਾ ਸੀਗਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਵੀ ਪ੍ਰੋਬਲਮ ਤਾਂ ਨਹੀਂ ਆ ਰਹੀ ਸਿਲੇਬਸ ਦੇ ਰਿਲੇਟਡ ਜਾਂ ਕੋਈ ਡਾਊਟਸ ਹੋਣ ਜੇ ਤੁਹਾਨੂੰ ਫਕਿਲਟੀ ਦੇ ਰਿਗਾਰਡ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਉਹ ਵੀ ਚੇਂਜ ਕਰਵਾ ਸਕਦੇ ਹਾਂ ਓਕੇ ਬੱਚੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਟੀਚਰ ਦੇ ਰਿਲੇਟਡ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਸਿਲੇਬਸ ਦੇ ਰਿਲੇਟਡ ਓਕੇ ਟੀਚਰ ਰਿਲੇਟਡ ਇਕਨੋਮਿਕਸ ਅਕਾਊਂਟਸ ਦੀ ਸਿਲੇਬਸ ਸਿਲੇਬਸ ਦੇ ਵਿੱਚ ਕੀ ਪ੍ਰੋਬਲਮ ਹੈ ਓਕੇ ਬੱਚੇ ਕੋਈ ਨਾ ਆਈ ਵਿਲ ਟੋਕ ਟੂ ਯੂਅਰ ਟੀਚਰ ਅਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਮੈਂ ਟੀਚਰ ਨਾਲ ਗੱਲ ਕਰਕੇ ਤੁਹਾਡੇ ਡਾਊਟ ਕਲੀਅਰ ਕਰਵਾ ਦੂੰਗੀ ਇਕਨੋਮਿਕਸ ਨੂੰ ਲੈ ਕੇ ਕੋਈ ਡਾਊਟ ਰੂਡਲੀ ਗੱਲ ਕਿਉਂ ਕਰਦੇ ਆ ਤੁਸੀਂ ਕੋਈ ਗਲਤੀ ਕੀਤੀ ਹੋਏਗੀ ਉਸ ਤੋਂ ਗੱਲ ਕਰਦੇ ਆ ਜਾਂ ਐਵੇਂ ਹੀ ਬੋਲਦੇ ਕਿੱਦਾਂ ਓਕੇ ਕੋਈ ਨਾ ਬੱਚੇ ਮੈਂ ਗੱਲ ਕਰ ਲੂੰਗੀ ਟੀਚਰ ਨਾਲ ਆਪਾਂ ਪਹਿਲਾਂ ਟੀਚਰ ਨੂੰ ਸਮਝਾ ਜਾਵਾਂਗੇ ਜੇ ਉਸਦੇ ਬਾਅਦ ਵੀ ਟੀਚਰ ਕੋਈ ਗਲਤੀ ਕਰਦਾ ਏ ਫਿਰ ਆਪਾਂ ਕੋਈ ਗੱਲ ਨਹੀਂ ਟੀਚਰ ਦੇ ਨਾਲ ਵੀ ਗੱਲ ਕਰ ਲਾਂਗੇ ਫਿਰ ਆਪਾਂ ਪ੍ਰਿੰਸੀਪਲ ਸਰ ਨਾਲ ਗੱਲ ਕਰਕੇ ਟੀਚਰ ਵੀ ਜੇ ਤੁਸੀਂ ਕਹੋਗੇ ਤਾਂ ਫਿਰ ਆਪਾਂ ਚੇਂਜ ਵੀ ਕਰਵਾ ਦੇਵਾਂਗੇ ਕੋਈ ਚੱਕਰ ਨਹੀਂ ਆ ਹਾਂਜੀ ਬੱਚੇ ਹੋਰ ਕੋਈ ਪ੍ਰੋਬਲਮ ਓਕੇ ਬੱਚੇ